ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ ਹਾਂਜੀ ਵਧੀਆ ਤੁਸੀਂ ਦੱਸੋ ਕਿਵੇਂ ਹੋ ਹਾਂਜੀ ਹਾਂ ਸਭ ਵਧੀਆ ਹਾਂਜੀ ਬੱਚੇ ਤਾਂ ਜੀ ਹਾਲੇ ਕਿਤੇ ਨਹੀਂ ਲਾਏ ਜੀ ਹਾਲੇ ਸੋਚਿਆ ਨਹੀਂ ਸਕੂਲ ਬਾਰੇ ਸੋਚ ਰਹੇ ਸੀ ਵੀ ਚੱਲ ਵਧੀਆ ਜਿਹੜਾ ਬੈਸਟ ਸਕੂਲ ਹੋਵੇ ਲਾ ਦੀਏ ਜਵਾਕਾਂ ਨੂੰ ਹਾਂਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਹਾਂਜੀ ਅੱਛਾ ਜੀ ਅੱਛਾ ਜੀ ਇੱਕ ਮੈਂ ਸਾਡੀ ਗਵਾਂਢਣ ਦਾ ਜਵਾਕ ਲੱਗਿਆ ਹੋਇਆ ਜੀ ਉਹਨਾਂ ਨੇ ਦੱਸਿਆ ਸੀ ਬਾਬਾ ਬਾਬਾ ਗਾਂਦਾ ਸਕੂਲ ਹਾਂਜੀ ਦੂਰ ਵੀ ਠੀਕ ਆ ਅਤੇ ਫੀਸ ਵੀ ਲੋਟ ਆ ਉਹਨਾਂ ਦੀ ਅਤੇ ਥੋੜ੍ਹੀ ਜਿਹੀ ਪੜ੍ਹਾਈ 'ਚ ਦਿੱਕਤ ਜਿਹੀ ਆਉਂਦੀ ਆ ਓਕੇ ਓਕੇ ਹਾਂਜੀ ਹਾਂਜੀ ਅਤੇ ਬਾਈ ਐਸ ਸਕੂਲ ਵੀ ਠੀਕ ਆ ਜੀ ਊਂ ਤਾਂ ਉੱਥੇ ਫੀਸ ਵੀ ਲੋਟ ਆ ਅਤੇ ਪੜ੍ਹਾਈ ਵੀ ਬਾਈ ਐਸ ਸਕੂਲ ਜੀ ਹਾਂਜੀ ਹਾਂ ਬੈਸਟ ਸਕੂਲ ਆ ਜੀ ਉਹ ਅਤੇ ਪੜ੍ਹਾਈ ਵੀ ਠੀਕ ਆ ਉੱਥੇ ਫੀਸ ਵੀ ਲੋਟ ਆ ਜੀ ਅਤੇ ਆਪਾਂ ਨੂੰ ਨੇੜੇ ਵੀ ਆ ਬੱਚੇ ਨੂੰ ਦਿੱਕਤ ਨਹੀਂ ਆਉਗੀ ਆਉਣ ਜਾਣ 'ਚ ਹਾਂਜੀ ਹਾਂ ਹਾਂਜੀ ਹਾਂਜੀ ਆਜਿਓ ਆਜਿਓ ਜੀ ਸਾਢੇ ਕੁ ਅੱਠ ਵਜੇ ਤੱਕ ਹਾਂਜੀ ਓਕੇ ਬਾਏ